ਹਾਂ ਅੱਜ ਕੱਲ੍ਹ ਦੇ ਜੋ ਬੱਚੇ ਹਨ ਉਹ ਸਕਰੀਨਾਂ ਉੱਪਰ ਗੇਮਸ ਖੇਡਦੇ ਹਨ ਜਾਂ ਸੋਸ਼ਲ ਮੀਡੀਆ ਵਗੈਰਾ ਯੂਜ ਕਰਦੇ ਹਨ ਜਿਹਨਾਂ ਕਾਰਨ ਉਹਨਾਂ ਨੂੰ ਸਰੀਰਕ ਬਿਮਾਰੀ ਜਾਂ ਮਾਨਸਿਕ ਬਿਮਾਰੀ ਲੱਗ ਜਾਂਦੀ ਹੈ ਜੋ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਹ ਅੱਜ ਕੱਲ੍ਹ ਦੇ ਬੱਚੇ ਬਹੁਤ ਜ਼ਿਆਦਾ ਮੋਬਾਇਲ ਉਹ ਯੂਜ ਕਰਦੇ ਆ ਜਾਂ ਟੀ ਵੀ ਵਗੈਰਾ ਬਹੁਤ ਜ਼ਿਆਦਾ ਦੇਖਦੇ ਹਨ ਜਿਹਨਾਂ ਕਾਰਨ ਉਹਨਾਂ ਨੂੰ ਅੱਖਾਂ ਅੱਖਾਂ ਦੀ ਪ੍ਰੋਬਲਮ ਹੋ ਸਕਦੀ ਹੈ ਅਤੇ ਜਾਂ ਹੋਰ ਵੀ ਕਈ ਬਿਮਾਰੀਆਂ ਹਨ ਜੋ ਉਹਨਾਂ ਨੂੰ ਲੱਗ ਸਕਦੀਆਂ ਹਨ ਉਹ ਆਪਣਾ ਮਨੋਰੰਜਨ ਫੋਨ ਉੱਪਰ ਹੀ ਗੇਮਸ ਜਾਂ ਕੁਛ ਹੋਰ ਵਗੈਰਾ ਵੇਖ ਕੇ ਹੀ ਕਰ ਲੈਂਦੇ ਹਨ ਉਹਨਾਂ ਨੂੰ ਬਾਹਰ ਜਾ ਕੇ ਅ ਖੇਡਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਉਹ ਆਪਣੇ ਸਰੀਰ ਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ ਘਰ ਬੈਠੇ ਹੀ ਆਰਾਮ ਨਾਲ ਫੋਨ ਉੱਪਰ ਹੀ ਸਭ ਕੁਝ ਕਰਨਾ ਚਾਹੁੰਦੇ ਹਨ ਫੋਨ ਉੱਪਰ ਹੀ ਗੇਮਾਂ ਖੇਡ ਕੇ ਆਪਣਾ ਮਨੋਰੰਜਨ ਕਰ ਲੈਂਦੇ ਹਨ ਜਦੋਂ ਕਿ ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਬਾਹਰ ਜਾ ਕੇ ਖੇਡਣਾ ਚਾਹੀਦਾ ਹੈ ਹੋਰ ਕਈ ਗੇਮਾਂ ਖੇਡ ਕੇ ਉਹਨਾਂ ਨੂੰ ਆਪਣਾ ਮਨੋਰੰਜਨ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਦੇ ਘਰਦਿਆਂ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਫੋਨ ਲਿਮਿਟ 'ਚ ਦੇਣ ਅਤੇ ਟੀ ਵੀ ਵੀ ਟੀ ਵੀ ਜਾਂ ਫੋਨ ਵਗੈਰਾ ਉਹਨਾਂ ਨੂੰ ਬਹੁਤ ਹੀ ਘੱਟ ਯੂਜ ਕਰਨ ਦੇਣ ਜਿਸ ਕਾਰਨ ਉਹਨਾਂ ਨੂੰ ਬਾਹਰ ਜਾ ਕੇ ਖੇਡਣ ਵਿੱਚ ਦਿਲਚਸਪੀ ਪੈਦਾ ਹੋਵੇ ਅਤੇ ਉੱਥੋਂ ਦੇ ਲੋਕਾਂ ਜਾਂ ਉਹਨਾਂ ਜਾਂ ਸਕੂਲ ਵਿੱਚ ਜਾਂ ਉੱਥੋਂ ਦੇ ਲੋਕਾਂ ਨੂੰ ਟੂਰਨਾਮੈਂਟ ਜਾਂ ਕਈ ਗੇਮਾਂ ਦਾ ਦਾ ਆਯੋਜਿਤ ਕਰਨਾ ਚਾਹੀਦਾ ਹੈ ਜ ਜੋ ਕਿ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਨੂੰ ਦਿਲਚਸਪੀ ਦਿਲਚਸਪੀ ਹੋਵੇ ਅਤੇ ਅਤੇ ਉਹ ਉੱਥੇ ਜਾ ਕੇ ਖੇਡੇ ਅਤੇ ਉਹਨਾਂ ਨੂੰ ਉਹ ਮੁਕਾਬਲੇ ਜਿੱਤਣ ਦੀ ਚਾਹਤ ਪੈਦਾ ਹੋਵੇ ਅਤੇ ਉਹ ਫੋਨ ਜਾਂ ਸਕਰੀਨ ਨੂੰ ਯੂਜ ਕ ਯੂਜ ਨਾ ਕਰੇ ਅਤੇ ਬਾਹਰ ਜਾ ਕੇ ਖੇਡਾਂ ਖੇਡ ਕੇ ਆਪਣਾ ਮਨੋਰੰਜਨ ਕਰ